ਔਨਲਾਈਨ ਕੋਚਿੰਗ ਅਤੇ ਸਕੂਲਿੰਗ ਨੇ ਵਿਦਿਆਰਥੀਆਂ ਦੇ ਜੀਵਨ 'ਤੇ ਬਹੁਤ ਪ੍ਰਭਾਵ ਪਾਇਆ ਹੈ ਇਸ ਰਾਹੀਂ ਵਿਦਿਆਰਥੀ ਘਰ ਹੀ ਬੈਠੇ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹਨ ਅਗਰ ਉਹਨਾਂ ਦਾ ਸਿਲੇਬਸ ਖ਼ਤਮ ਨਹੀਂ ਹੋਇਆ ਤਾਂ ਉਹ ਔਨਲਾਈਨ ਆਪਣਾ ਸਿਲੇਬਸ ਪੂਰਾ ਵੀ ਕਰ ਸਕਦੇ ਹਨ ਅਤੇ ਆਪਣੇ ਜਿੰਨੇ ਵੀ ਸਵਾਲਾਂ ਦੇ ਹੱਲ ਹਨ ਔਨਲਾਈਨ ਸਭ ਕੁਝ ਸਮਝ ਸਕਦੇ ਹਨ ਹੁਣ ਵਿਦਿਆਰਥੀ ਘਰ ਬੈਠੇ ਹੀ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹਨ ਉਹਨਾਂ ਨੂੰ ਟਿਊਸ਼ਨ ਜਾਣ ਦੀ ਵੀ ਕੋਈ ਲੋੜ ਨਹੀਂ ਹੈ